ਮੈਨੂੰ ਮੈਰਾਥੋਨ ਦੌੜਾਂ ਵਿੱਚ ਬੜੀ ਦਿਲਚਸਪੀ ਹੈ ਅਤੇ ਮੈਂ ਮੈਰਾਥੋਨ ਦੌੜ ਦੀ ਤਿਆਰੀ ਕਰਨ ਸਮੇਂ ਮੈਂ ਸਵੇਰੇ ਚਾਰ ਵਜੇ ਉੱਠਦਾ ਸੀ ਅਤੇ ਮੈਂ ਲਗਭਗ ਦੋ ਮਹੀਨੇ ਪਹਿਲਾਂ ਇਹਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਮੈਂ ਸਵੇਰੇ ਉੱਠ ਕੇ ਪਹਿਲਾਂ ਆਪਦੀ ਸਾਈਕਲ ਸਾਫ ਕਰਦਾ ਸੀ ਅਤੇ ਮੈਂ ਸਾਈਕਲ 'ਤੇ ਅਪੋਲੋ ਗਰਾਊਂਡ ਵਿੱਚ ਜਾਂਦਾ ਸੀ ਅਤੇ ਜਿੱਥੇ ਮੈਂ ਆਪਦਾ ਵਰਕਆਊਟ ਸ਼ੁਰੂ ਕਰਦਾ ਸੀ ਅਤੇ ਵਰਕਆਊਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਥੋੜ੍ਹੀ ਜਿਹੀ ਡਾਈਟ ਖਾਂਦਾ ਸੀ ਜਿਸ ਨਾਲ ਮੇਰਾ ਸਰੀਰ ਦੇ ਵਿੱਚ ਜਾਨ ਬਣੀ ਰਹੇ ਅਤੇ ਅਤੇ ਮੈਂ ਸਾਈਕਲ 'ਤੇ ਹੀ ਜਾਂਦਾ ਸੀ ਅਤੇ ਸਾਈਕਲ 'ਤੇ ਹੀ ਵਰਕਆਊਟ ਕਰਕੇ ਘਰ ਵਾਪਸ ਆਉਂਦਾ ਸੀ ਅਤੇ ਜਿਸ ਕਾਰਨ ਮੇਰਾ ਸਰੀਰ ਬਹੁਤ ਹੀ ਤੰਦਰੁਸਤ ਰਹਿੰਦਾ ਸੀ ਅਤੇ ਜਦੋਂ ਮੈਂ ਸ਼ਾਮ ਨੂੰ ਵੀ ਮੇਰਾ ਆਹੀ ਰੂਟੀਨ ਹੁੰਦਾ ਸੀ ਅਤੇ ਸ਼ਾਮ ਨੂੰ ਵੀ ਮੈਂ ਸਾਈਕਲ 'ਤੇ ਹੀ ਅਪੋਲੋ ਗਰਾਊਂਡ ਜਾਣਾ ਅਤੇ ਦੋ ਘੰਟੇ ਵਰਕਆਊਟ ਕਰਨਾ ਅਤੇ ਨਾਲ ਨਾਲ ਮੈਂ ਫੁੱਟਬਾਲ ਵੀ ਖੇਡਦਾ ਸੀ ਵੀ ਜਿਸ ਕਾਰਨ ਮੇਰੀ ਰਨਿੰਗ ਸਕਿੱਲਸ ਹੋਰ ਵਧੀਆ ਹੋਣ ਅਤੇ ਮੈਨੂੰ ਹੋਰ ਤਰੀਕੇ ਨਾਲ ਇਸ ਚੀਜ਼ ਦਾ ਫਾਇਦਾ ਹੋਵੇ ਅਤੇ ਮੈਂ ਦੋ ਹਜ਼ਾਰ ਉੱਨੀ ਦੀਆਂ ਮੈਰਾਥਨ ਖੇਡਾਂ ਵਿੱਚ ਵੀ ਭਾਗ ਲਿਆ ਸੀ ਅਤੇ ਜਿਸ ਵਿੱਚ ਮੈਂ ਵੀ ਇਸੇ ਤਰ੍ਹਾਂ ਹੀ ਤਿਆਰੀ ਕੀਤੀ ਸੀ ਅਤੇ ਜਿਸ ਵਿੱਚ ਮੈਨੂੰ ਬਹੁਤ ਚੰਗਾ ਲੱਗਿਆ ਸੀ ਤਿਆਰੀ ਕਰਕੇ ਅਤੇ ਭਾਗ ਲੈ ਕੇ ਅਤੇ ਹੁਣ ਵੀ ਮੈਂ ਇਵੇਂ ਹੀ ਗਰਾਉਂਡ ਵਿੱਚ ਜਾਂਦਾ ਹਾਂ ਜਿਵੇਂ ਦੋ ਹਜ਼ਾਰ ਉੱਨੀ ਦੀਆਂ ਖੇਡਾਂ ਵਿੱਚ ਜਾਂਦਾ ਸੀ ਅਤੇ ਹੁਣ ਮੈਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਹੁਣ ਜਦੋਂ ਇਹ ਖੇਡਾਂ ਹੋਣਗੀਆਂ ਤਾਂ ਮੈਂ ਆਪਣੀ ਪੂਰੀ ਜਾਨ ਲਾ ਕੇ ਇਹਦੇ ਵਿੱਚ ਪ੍ਰਦਰਸ਼ਨ ਕਰਾਂਗਾ ਅਤੇ ਇਸ ਕਰਕੇ ਹੀ ਮੈਂ ਇਸ ਖੇਡਾਂ ਵਿੱਚ ਭਾਗ ਲੈ ਰਿਹਾ ਹਾਂ ਕਿ ਮੇਰਾ ਸਰੀਰ ਤੰਦਰੁਸਤ ਰਹੇ ਅਤੇ ਸ ਸਭ ਕੁਝ ਬਹੁਤ ਹੀ ਵਧੀਆ ਤਰੀਕੇ ਨਾਲ ਹੋਵੇ ਅਤੇ ਮੈਂ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਹੈ ਅਤੇ ਮੈਂ ਇਸ ਖੇਡ ਨੂੰ ਬਹੁਤ ਵਧੀਆ ਤਰੀਕੇ ਨਾਲ ਖੇਡਾਂਗਾ ਅਤੇ ਮੈਰਾਥਨ ਦੌੜਾਂ ਵਿੱਚ ਭਾਗ ਲਵਾਂਗਾ